ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਗਿਆਨ ਅਤੇ ਟੈਕਨੋਲਜੀ ਵਿੱਚ ਤਰੱਕੀ ਨੇ ਸਿਹਤ ਸੰਭਾਲ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਸਹੂਲਤ ਪ੍ਰਾਪਤ ਕੀਤੀ ਹੈ

ਸ਼ਹਿਰ ਦੇ ਵਿੱਚ ਕਿਸ ਪਰਟੀਕੁਲਰ ਜਗ੍ਹਾ ਦੇ ਉੱਤੇ ਜਾ ਕੇ ਆਪਣਾ ਕੋਵਿਡ ਕਰਨ ਕਰ ਸਕਦੇ ਹਾਂ ਕੋਵਿਡ ਟੀਕਾਕਰਨ ਹੋ ਸਕਦਾ ਹੈ ਸੋ ਕੋਵਿਡ ਮਹਾਂਮਾਰੀ ਦੇ ਵਿੱਚ ਟੈਕਨੋਲਜੀ ਅਤੇ ਵਿਗਿਆਨ ਨੇ ਬਹੁਤ ਜ਼ਿਆਦਾ